ਅਸੀਂ ਪਿੰਡਾਂ ਵਾਲੇ ਪਿੰਡਾਂ ਵਿੱਚ ਰਹਿੰਦੇ ਹਾਂ ਜਿਹੜੇ ਅਸੀਂ ਪਸ਼ੂਆਂ ਨਾਲ ਹੀ ਜ਼ਿਆਦਾ ਮੋਹ ਪਿਆਰ ਹੈਗਾ ਅਤੇ ਪਸ਼ੂਆਂ ਦੀ ਦੇਖਭਾਲ ਕਰਦੇ ਹਾਂ ਪਸ਼ੂਆਂ ਨੂੰ ਅਸੀਂ ਸਿਹਤ ਸੰਭਾਲ ਦਿੰਦੇ ਹਾਂ ਅਤੇ ਪਸ਼ੂਆਂ 'ਚੋਂ ਹੀ ਫਾਇਦਾ ਜੇ ਉਹ ਉਠਾਉਂਦੇ ਹਾਂ ਅਸੀਂ ਪਸ਼ੂਆਂ 'ਚੋਂ ਛੋਟੇ ਜਿਹੜੇ ਗਰੀਬ ਕਿਸਾਨ ਆ ਗਏ ਅਤੇ ਅਸੀਂ ਪਸ਼ੂਆਂ ਦੇ ਨਾਲ ਹੀ ਜੁੜੇ ਹਾਂ ਸਰਕਾਰੀ ਜਿਹੜੇ ਹਸਪਤਾਲ ਪਸ਼ੂਆਂ ਵਾਲੇ ਸਾਨੂੰ ਫਰੀ ਦੀ ਉੱਥੋਂ ਦਵਾਈ ਮਿਲ ਜਾਂਦੀ ਹੈ ਅਤੇ ਸਾਡਾ ਚੰਗਾ ਪੀ ਉਹ ਹੋ ਜਾਂਦਾ ਪਸ਼ੂਆਂ ਦੀ ਸਿਹਤ ਸੰਭਾਲ ਹੋ ਜਾਂਦੀ ਹੈ ਜੋ ਵੀ ਕੋਈ ਪਸ਼ੂਆਂ ਦੇ ਲੱਗਣਾ ਟੀਕਾ ਡੋਟ ਅਸੀਂ ਉਹ ਸਰਕਾਰੀ ਸਕੂਲੋਂ ਹਸਪਤਾਲ 'ਚੋਂ ਹੀ ਲਗਵਾਉਂਦੇ ਹੈ ਪਸ਼ੂਆਂ ਦੇ ਪਸ਼ੂਆਂ ਦੇ ਬੀਮੇ ਆ ਬੀਮਾ ਹੋ ਜਾਂਦਾ ਅਤੇ ਪਸ਼ੂਆਂ ਦਾ ਜੋ ਬੀਮਾ ਹੁੰਦਾ ਅਤੇ ਉਹ ਸਾਨੂੰ ਕੋਈ ਪਸ਼ੂਆਂ ਨੂੰ ਕੋਈ ਹੇਮਕੋਟ ਹੋਈਏ ਤਾਂ ਸਾਨੂੰ ਪ ਪੈਸਾ ਮਿਲ ਜਾਂਦਾ ਇੰਨੀ ਸਾਨੂੰ ਸਹੂਲਤ ਸਰਕਾਰ ਵੀ ਚੱਲ ਦਿੱਤੀ ਜਾਂਦੀ ਹੈ ਅਤੇ ਇਹਨਾਂ ਪਸ਼ੂਆਂ ਨੂੰ ਅਸੀਂ ਜਿਹੜੇ ਕਿਸਾਨ ਅਸੀਂ ਪਸ਼ੂਆਂ ਨਾਲ ਜੁੜੇ ਹਾਂ ਅਤੇ ਸਾਡਾ ਇਹਨਾਂ ਤੇੋਂ ਜਿਊਣ ਗੁਜ਼ਾਰਾ ਹੋ ਜਾਂਦਾ ਟਾਈਮ ਪਾਸ ਹੋ ਜਾਂਦਾ ਅਤੇ ਪਸ਼ੂਆਂ ਦੇ ਨਾਲ ਹੀ ਸਾ ਅਸੀਂ ਪਸ਼ੂਆਂ ਦੀ ਸਿਹਤ ਸੰਭਾਲ ਰੱਖਦੇ ਹਾਂ ਅਤੇ ਪਸ਼ੂਆਂ ਦੇ ਨਾਲ ਜੁੜੇ